ਇੱਥੇ ਮਛੇਰਿਆਂ ਦੀਆਂ ਕਈ ਜਾਤਾਂ ਹਨ ਅਤੇ ਕਈ ਬੰਦੇ ਸਾਰੇ ਮਿਲ ਕੇ ਰਹਿੰਦੇ ਨੇ ਕੋਈ ਭੇਦਭਾਵ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ ਮੱਛੀ ਫੜਨ ਬਾਰੇ ਤਾਂ ਮੱਛੀ ਵੀ ਹਰੇਕ ਜਾਤ ਫੜਦੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਅਤੇ ਮਛੇਰਿਆਂ ਭਾਈਚਾਰੇ ਤਿਉਹਾਰ ਦੀ ਗੱਲ ਹੁੰਦੀ ਹੈ ਤਿਉਹਾਰ ਸਾਰੇ ਰਲ ਮਿਲ ਕੇ ਮਨਾਉਂਦੇ ਹਨ ਕਈ ਪੰਜਾਬ ਦੇ ਮਛੇਰੇ ਨੇ ਉਹ ਵਿਸਾਖੀ ਵੀ ਮਨਾਉਂਦੇ ਹਨ ਐਂ ਤਾਂ ਕੋਈ ਹੈ ਨਹੀਂ ਜੀ ਇਕੱਲਾ ਉਹ ਇਕੱਲਾ ਉ ਉਹ ਹੀ ਮਨਾਉਣੇ ਕੋਈ ਆਪਣੀ ਜਾਤ ਮਨਾਣਗੇ ਕੁਛ ਵੀ ਆਪਣਾ ਤਿਉਹਾਰ ਮਨਾਉਣਗੇ ਸਾਰੇ ਤਿਉਹਾਰ ਮਨਾਉਂਦੇ ਹਨ ਇੰਡੀਆ 'ਚ ਆਪਾਂ ਰਹਿੰਦੇ ਹੈ ਇੰਡੀਆ ਸਾਨੂੰ ਰੀਪ੍ਰਜੈਂਟ ਕਰ ਰਿਹਾ ਹੈ ਅਤੇ ਰਹਿਣ ਦਿੰਦਾ ਹੈ ਅਸੀਂ ਇੰਡੀਆ ਨੂੰ ਰੀਪ੍ਰਜੈਂਟ ਕਰਦੇ ਹੈ ਕਿਉਂਕਿ ਆਪਾਂ ਇੰਡੀਆ 'ਚ ਰਹਿੰਦੇ ਹੈ ਬ ਆਪਾਂ ਬਾਹਰ ਜਾਈਏ ਤਾਂ ਆਪਾਂ ਇਹੀ ਦੱਸਾਂਗੇ ਕਿ ਆਪਾਂ ਇੰਡੀਆ 'ਚ ਰਹਿੰਦੇ ਹੈ ਇਸ ਕਰਕੇ ਹਰੇਕ ਤਿਉਹਾਰ ਹਰੇਕ ਬੰਦਾ ਮਨਾਉਂਦਾ ਸਾਰਿਆਂ ਨੂੰ ਇਕੁਅਲ ਸਮਝਿਆ ਜਾਂਦਾ ਹੈ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੈ